ਅਸੀਂ ਵਿਹੜੇ ਵਿੱਚ ਇੱਕ ਬਾਰ ਵੀ ਕਿਊ ਪਾਰਟੀ ਦੀ ਮੇਜ਼ਬਾਨੀ ਕਰ ਰਹੇ ਹਾਂ ਅਤੇ ਜਿਸ ਵਿੱਚ ਬਚਿਆ ਹੋਇਆ ਭੋਜਨ ਦੀ ਰਹਿੰਦ ਖੂੰਹਦ ਦਾ ਨਿਪਟਾਰਾ ਕਰਨ ਦੀ ਜ਼ਰੂਰਤ ਹੈ ਅਤੇ ਅਸੀਂ ਸਾਫ ਸਫਾਈ ਕਰਨੀ ਚਾਹੁੰਦੇ ਹਾਂ ਕੱਲ੍ਹ ਰਾਤ ਸਾਡੇ ਘਰ ਬਹੁਤ ਵੱਡੀ ਪਾਰਟੀ ਸੀ ਜਿਸ ਵਿੱਚ ਸੌ ਬੰਦੇ ਆਏ ਸਨ ਅਤੇ ਉਸ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਬਣੀਆਂ ਸਨ ਜਿਵੇਂ ਕਿ ਜਿਵੇਂ ਪਨੀਰ ਚੌਲ ਮਟਰ ਪਨੀਰ ਆਹ ਪਾਲਕ ਪਨੀਰ ਗੁਲਾਬ ਜਾਮਣਾਂ ਰਸ ਮਲਾਈ ਚਿਕਨ ਅਤੇ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਖਾਣਾ ਬਣਿਆ ਸੀਗਾ ਅਤੇ ਖਾਣਾ ਸੌ ਬੰਦੇ ਪਾਰਟੀ ਵਿੱਚ ਸਨ ਅਤੇ ਖਾਣਾ ਖਾਣ ਤੋਂ ਬਾਅਦ ਵੀ ਬਹੁਤ ਹੀ ਜ਼ਿਆਦਾ ਖਾਣਾ ਬਚ ਚੁੱਕਿਆ ਸੀਗਾ ਜੋ ਕਿ ਸਾਫ਼ ਖਾਣਾ ਵੀ ਸੀਗਾ ਜੋ ਕਿ ਵੇਸਟਿੰਗ ਵੀ ਹੋਇਆ ਸੀ ਜੂਠਾ ਖਾਣਾ ਸੀ ਉਹ ਵਾਲਾ ਖਾਣਾ ਵੀ ਅਤੇ ਜ਼ਿਆਦਾ ਬਚ ਚੁੱਕਿਆ ਸੀਗਾ ਜਿਸ ਵਿੱਚ ਡਿਸਪੋਜਲ ਦੇ ਡਿਸਪੋਜਲ ਵਿੱਚ ਖ ਜੋ ਡਿਸਪੋਜਲ ਸੀਗਾ ਉਹ ਵੀ ਜ਼ਿਆਦਾ ਹੀ ਉਹ ਵੇਸਟ ਹੋ ਚੁੱਕਿਆ ਸੀਗਾ ਇਸ ਕਰਕੇ ਸਾਡੇ ਘਰ ਬਹੁਤ ਹੀ ਜ਼ਿਆਦਾ ਗਾਹ ਪਿਆ ਪਿਆ ਹੈਗਾ ਇਸ ਸਾਨੂੰ ਜਲਦ ਤੋਂ ਜਲਦ ਇੱਕ ਰਹਿੰਦ ਖੂੰਹਦ ਦੀ ਸਫਾਈ ਕਰਨ ਵਾਲਾ ਕੂੜਾ ਕਰਨ ਨਿਪਟਾਰਾ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਾਡੀ ਸਾਡੀ ਸਹਾਇਤਾ ਕੀਤੀ ਜਾਵੇ ਅਤੇ ਕੋਈ ਮਸ਼ੀਨ ਜਾਂ ਇਸ ਤਰ੍ਹਾਂ ਦੀ ਚੀਜ਼ ਕੋਈ ਜੋ ਕਿ ਸਾਰੇ ਕੂੜੇ ਨੂੰ ਸਾਫ ਸਫਾਈ ਕਰ ਸਕੇ ਅਤੇ ਪੂਰੀ ਵਧੀਆ ਤਰ੍ਹਾਂ ਸਫਾਈ ਹੋ ਸਕੇ ਇਸ ਮੇਨਜਮੈਂਟ ਵਿੱਚ ਕੂੜਾ ਸਾਰਾ ਚੰਗੀ ਤਰ੍ਹਾਂ ਸਾਫ ਹੋਣਾ ਚਾਹੀਦਾ ਅਤੇ ਵਧੀਆ ਹੋਣਾ ਚਾਹੀਦਾ ਹੈ ਪੂਰੀ ਚੰਗੀ ਤਰ੍ਹਾਂ ਸਾਫ ਸਫਾਈ ਹੋਣੀ ਚਾਹੀਦੀ ਹੈ ਅਤੇ ਇੱਕ ਵਿਸ਼ੇਸ਼ ਕੂੜਾ ਇਕੱਠਾ ਕਰਨ ਦੀ ਬੇਨਤੀ ਕਰਨਾ ਚਾਹੁੰਦੇ ਹਾਂ ਅਤੇ ਆਪਣੀ ਬਾਰ ਵੀ ਕਿਉ ਪਾਰਟੀ ਤੋਂ ਬਚੇ ਹੋਏ ਭੋਜਨ ਦੀ ਰਹਿੰਦ ਖੂੰਹਦ ਨੂੰ ਇੱਕ ਵਿਸ਼ੇਸ਼ ਕੂੜਾ ਇਕੱਠਾ ਕਰਨ ਦੀ ਬੇਨਤੀ ਲਈ ਸਹਾਇਤਾ ਰਹਿੰਦ ਖੂੰਹਦ ਪ੍ਰਬੰਧਕ ਆਰਥਿਕ ਨੂੰ ਕਾਲ ਕਰਨ ਦੀ ਕਲਪਨਾ ਕਲਪਨਾ ਕਰੋ ਸਥਿਤੀ 'ਤੇ ਵਰਣਨ